ਮੈਂ ਸੁੰਨਸਾਨ ਰਸਤੇ ਜਾ ਰਿਹਾ ਸੜਕ ਬਹੁਤ ਖਰਾਬ ਸੀਗੀ ਅਤੇ ਜਾਂਦੇ ਜਾਂਦੇ ਮੇਰਾ ਸਾਈਕ ਮੋਟਰਸਾਈਕਲ ਦਾ ਟਾਇਰ ਪੈਂਚਰ ਹੋ ਗਿਆ ਅਤੇ ਮੈਂ ਬਹੁਤ ਪਰੇਸ਼ਾਨ ਹੋਇਆ ਅਤੇ ਮੈਂ ਉਹਨੂੰ ਰੋੜ੍ਹ ਕੇ ਕਾਫੀ ਦੂਰ ਤੱਕ ਮੈਂ ਲੈ ਕੇ ਗਿਆ ਵਾਂ ਉਹਨੂੰ ਅਤੇ ਮੈਨੂੰ ਕੋਈ ਪੈਂਚਰ ਵਾਲਾ ਨਹੀਂ ਲੱਭਿਆ ਕਾਫੀ ਟਾਈਮ 'ਤੇ ਉੱਥੇ ਇੱਕ ਹੋਟਲ ਵਾਲਾ ਤ ਜਿੱਦਾਂ ਢਾਬਾ ਹੁੰਦਾ ਢਾਬੇ ਵਾਲੇ ਤੋਂ ਪੁੱਛਿਆ ਉਹਨੇ ਕਾਫੀ ਟਾਈਮ ਤੋਂ ਅੱਗੇ ਤਿੰਨ ਚਾਰ ਕਿਲੋਮੀਟਰ ਤੋਂ ਅੱਗੇ ਮੈਨੂੰ ਦੱਸਿਆ ਕਿ ਫਲਾਣੀ ਜਗ੍ਹਾ 'ਤੇ ਬੰਦਾ ਇੱਕ ਪੈਂਚਰ ਲਾਉਂਦਾ ਤੁਸੀਂ ਉਹਨਾਂ ਕੋਲ ਪੈਂਚਰ ਲਵਾ ਲਓ ਮੈਂ ਕਾਫੀ ਟਾਈਮ ਤੋਂ ਉਹਨਾਂ ਕੋਲੋਂ ਕਾਫੀ ਟਾਈਮ ਤੱਕ ਮੈਂ ਤੁਰ ਕੇ ਉਹਨਾਂ ਕੋਲ ਗਿਆ ਫਿਰ ਮੈਂ ਉਹਨਾਂ ਕੋਲ ਪੈਂਚਰ ਲਵਾਇਆ ਮੈਨੂੰ ਬਹੁਤ ਤਕਲੀਫ ਹੋਈ ਕਿਉਂਕਿ ਉਹਨਾਂ ਨੇ ਪੈਂਚਰ ਲਾਉਣ 'ਤੇ ਵੀ ਬਹੁਤ ਟਾਈਮ ਸਮਾਂ ਖਰਾਬ ਕਰ ਦਿੱਤਾ ਮੇਰਾ ਕਿਉਂਕਿ ਸੜਕ ਖਰਾਬ ਹੋਣ ਕਰਕੇ ਮੈਨੂੰ ਬਹੁਤ ਪਰੇਸ਼ਾਨੀ ਹੋਈ ਹੈ ਮੇਰਾ ਮੋਟਰਸਾਈਕਲ ਪੈਂਚਰ ਹੋਇਆ ਮੈਂ ਬਹੁਤ ਪਰੇਸ਼ਾਨ ਹੋਇਆ ਉਹਦੇ ਕਰਕੇ ਮੇਰਾ ਬਾਈਕ ਦਾ ਟਾਇਰ ਪੈਂਚਰ ਹੋਇਆ ਜੀ ਅਤੇ ਬਾਇਕ ਪੈਂਚਰ ਲਵਾਉਣ ਲੱਗੇ ਬਹੁਤ ਟਾਈਮ ਲੱਗ ਗਿਆ ਮੈਨੂੰ